ਸੈਲਾਨੀਆਂ ਜਿੱਦਾਂ ਕਿ ਟੂਰਿਸਟ ਟੂਰਿਸਟ ਜਦੋਂ ਵੀ ਸਾਡੇ ਦੇਸ਼ ਵਿੱਚ ਆਉਂਦੇ ਹਨ ਤਾਂ ਉਹਨਾਂ ਨਾਲ ਗੱਲਬਾਤ ਕਰਕੇ ਬੜਾ ਅੱਛਾ ਲੱਗਦਾ ਹੈ ਕਿਉਂਕਿ ਉਹ ਕਾਫ਼ੀ ਅੱਛੇ ਦਿਲ ਦੇ ਹੁੰਦੇ ਹਨ ਕਾਫ਼ੀ ਉਹਨਾਂ ਦਾ ਅਲੱਗ ਜਿਹੀ ਵਾਇਵ ਹੁੰਦੀ ਹੈ ਉਹਨਾਂ ਨੂੰ ਅੰਦਰ ਕਿਉਂਕਿ ਉਹਨਾਂ ਨਾਲ ਜੋ ਆਪਾਂ ਗੱਲ ਕਰਦੇ ਹਨ ਤਾਂ ਇੱਦਾਂ ਲੱਗਦਾ ਹੀ ਨਹੀਂ ਕਿ ਉਹ ਕੋਈ ਪਰਾਇਆ ਹੈਗਾ ਕਿਉਂਕਿ ਉਸ ਤਰ੍ਹਾਂ ਹੀ ਗੱਲ ਕਰਦੇ ਹਨ ਫਰੀ ਹੋ ਕੇ ਗੱਲ ਕਰਦੇ ਹਨ ਅਤੇ ਉਹ ਜਦੋਂ ਸਾਨੂੰ ਆਪਣੇ ਦੇਸ਼ ਵਿੱਚ ਕੀ ਕੀ ਟੈਕਨੋਲੋਜੀ ਆ ਦੱਸਦੇ ਹਨ ਤਾਂ ਆਪਾਂ ਸੋਚਦੇ ਹਨ ਕਿ ਸਾਡੇ ਪੰਜਾਬ 'ਸਾਡੇ ਦੇਸ਼ ਵਿੱਚ ਇਹ ਚੀਜ਼ਾਂ ਆਉਣੀਆਂ ਚਾਹੀਦੀਆਂ ਹਨ ਅਤੇ ਉਹ ਕਾਫ਼ੀ ਖੁਸ਼ ਹੋ ਕੇ ਦੱਸਦੇ ਹਨ ਕਿ ਸਾਡੇ ਦੇਸ਼ ਵਿੱਚ ਇਹ ਚੀਜ਼ਾਂ ਬਣ ਗਈਆਂ ਹੈ ਟੈਕਨੋਲੋਜੀ ਆ ਗਈ ਹੋਈ ਆ ਕਾਫ਼ੀ ਚੀਜ਼ਾਂ ਆ ਗਈਆਂ ਹੋਈਆਂ ਨੇ ਅਤੇ ਆਪਾਂ ਤਾਂ ਉਹਨਾਂ ਨੂੰ ਦੱਸਦੇ ਆ ਕਿ ਸਾਡਾ ਵੀ ਪੰਜਾਬ ਘੱਟ ਨਹੀਂ ਸਾਡੇ ਦੇਸ਼ਾਂ ਵਿੱਚ ਕਾਫ਼ੀ ਚੀਜ਼ਾਂ ਹਨ ਜੋ ਉਹਨਾਂ ਦੇ ਦੇਸ਼ਾਂ ਵਿੱਚ ਨਹੀਂ ਹੋਣਗੀਆਂ ਕਿਉਂਕਿ ਜਿਹੜੇ ਟੂਰਿਸਟ ਹੈਗੇ ਹਨ ਉਹਨਾਂ ਨੇ ਤਾਂ ਆਪਣੇ ਦੇਸ਼ ਦੇ ਬਾਰੇ ਬੋਲਣਾ ਹੀ ਬੋਲਣਾ ਅਤੇ ਉਹ ਸਹੀ ਹੈ ਆਪਣੀ ਜਗ੍ਹਾ ਸਹੀ ਹੈ ਕਿ ਉਹ ਦੱਸਦੇ ਹਨ ਕਿ ਆਪਾਂ ਕਿੱਥੇ ਪਹੁੰਚ ਗਏ ਹਨ ਤੁਸੀਂ ਹਾਲੇ ਹੈਗੇ ਉੱਥੇ ਜਗ੍ਹਾ 'ਤੇ ਹੋ ਅਤੇ ਸਾਨੂੰ ਇਸ ਸੋਚਨਾ ਚਾਹੀਦਾ ਹੈ ਕਿ ਸਾਨੂੰ ਆਪਣੇ ਦੇਸ਼ ਵਿੱਚ ਵਧੀਆ ਵਧੀਆ ਸੁਧਾਰ ਕਰਨੇ ਚਾਹੀਦੇ ਹਨ ਤਾਂ ਕਿ ਆਪਾਂ ਵੀ ਜਦੋਂ ਬਾਹਰ ਜਾਈਏ ਤਾਂ ਆਪਾਂ ਵੀ ਦੱਸ ਪਾਈਏ ਕਿ ਹਾਂਜੀ ਜੀ ਸਾਡੇ ਪੰਜਾਬ ਸਾਡੇ ਦੇਸ਼ ਵਿੱਚ ਇਹ ਬਣਿਆ ਹੋਇਆ ਇਹ ਚੀਜ਼ਾਂ ਬਣੀਆਂ ਹੋਈਆਂ ਹਨ ਆਪਾਂ ਵੀ ਉਹਨਾਂ ਨੂੰ ਦੱਸੀਏ ਸਾਰਾ ਕੁਛ ਦੱਸੀਏ ਅਤੇ ਇਸ ਕਰਕੇ ਜਿਹੜੇ ਟੂਰਿਸਟਾਂ ਨਾਲ ਸਾਨੂੰ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਪਤਾ ਲੱਗਦਾ ਹੈ ਕਿ ਆਪਾਂ ਕਿੱਥੇ ਹੈਗੇ ਹਾਂ ਅਤੇ ਪਹੁੰਚ ਕਿੱਥੇ ਤੱਕ ਹੈਗੀ ਆਪਾਂ ਕੀ ਕੀ ਕੀ ਕੀ ਨਹੀਂ ਕੀਤਾ ਕੀ ਕਰ ਸਕਦੇ ਆਪਾਂ ਉਹਨਾਂ ਦੇ ਦੇਸ਼ ਵਿੱਚ ਉਹ ਸਿੱਖ ਕੇ ਕੀ ਕੀ ਕਰ ਸਕਦੇ ਹਾਂ ਆਪਾਂ ਸੈਲਾਨੀ ਕਾਫ਼ੀ ਹਰ ਨਹੀਂ ਹਰ ਨਹੀਂ ਕੋਈ ਇੱਦਾਂ ਬੋਲਦਾ ਹਰ ਸ ਸਾਰੇ ਸਹੀ ਹੁੰਦੇ ਹਨ ਕਈ ਹੁੰਦੇ ਨੇ ਜਿਹੜੇ ਆਪਣੇ ਰੋਅਬ ਝਾੜਦੇ ਹਨ ਅਤੇ ਕਈ ਹੁੰਦੇ ਨੇ ਜਿਹੜੇ ਮਤਲਬ ਕਿ ਕਾਫ਼ੀ ਅੱਛੇ ਦਿਲ ਦੇ ਹੁੰਦੇ ਹਨ ਅਤੇ ਕਈਆਂ ਨੂੰ ਕਈ ਹੁੰਦੇ ਹਨ ਜਿਨ੍ਹਾਂ ਨੂੰ ਮਦਦ ਦੀ ਵੀ ਲੋੜ ਹੁੰਦੀ ਹੈ ਕਿਉਂਕਿ ਉਹ ਦੇਸ਼ 'ਚ ਆਏ ਹੁੰਦੇ ਹਨ ਉਹਨਾਂ ਨੂੰ ਕਿਸੇ ਟਾਈਮ 'ਤੇ ਪੈਸੇ ਦੀ ਲੋੜ ਹੁੰਦੀ ਸਾਡੇ ਦੇਸ਼ ਵਿੱਚ ਬੜੇ ਅੱਛੇ ਲੋਕ ਹੈਗੇ ਜਿਹੜੇ ਉਹਨਾਂ ਦੀ ਮਦਦ ਕਰਦੇ ਹਨ ਉਹਨਾਂ ਨੂੰ ਬਿਨਾਂ ਪੈਸੇ ਦਿੱਤੇ ਕੋਈ ਚੀਜ਼ ਮਲਤਬ ਕਿ ਖਵਾ ਦਿੰਦੇ ਹਨ ਇੱਦਾਂ ਕਰਦੇ ਹਨ ਉਹਨਾਂ ਦੀ ਮਦਦ ਕਰਦੇ ਹਨ ਬਾਹਰ ਜਾਣ 'ਚ ਇਸ ਕਰਕੇ ਸਾਨੂੰ ਹਰ ਕੋਈ ਵੀ ਬਾਹਰੋਂ ਜਿਹੜਾ ਆਉਂਦਾ ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ ਉਹਦੀ ਮਦਦ ਕਰਨੀ ਚਾਹੀਦੀ ਹੈ ਨਾਲੇ ਉਹਨਾਂ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹਨ ਅਤੇ ਉਹਨਾਂ ਦੀ ਉਹਨਾਂ ਦੀ ਟੈਕਨੋਲੋਜੀ ਇਹਨਾਂ ਦੇ ਦੇਸ਼ ਵਿੱਚ ਕੀ ਬਣ ਚੁੱਕਿਆ ਵਾ ਅਤੇ ਉਹ ਲੈ ਕੇ ਸਾਨੂੰ ਆਪਣੇ ਦੇਸ਼ ਨੂੰ ਕਿੱਦਾਂ ਅੱਗੇ ਵਧਾਉਣਾ ਉਸ ਸੋਚਣਾ ਚਾਹੀਦਾ ਇਸ ਕਰਕੇ ਸੈਲਾਨੀਆਂ ਨਾਲ ਹਮੇਸ਼ਾ ਗੱਲ ਕਰਨੀ ਚਾਹੀਦੀ